ਪੰਜਾਬ ਵਿੱਚ ਬੈਂਕਿੰਗ ਅਤੇ ਖੇਤਰ ਸਮਾਜ ਨਾਲ ਇਸ ਤਰ੍ਹਾਂ ਜੁੜਿਆ ਹੋਇਆ ਹੈ ਕਿਉਂਕਿ ਸਮਾਜ ਨਾਲ ਅਲੱਗ ਰਹਿ ਕੇ ਇਹ ਬਿਜਨਸ ਜਾਂ ਇਹਨਾਂ ਦਾ ਕੰਮ ਨਹੀਂ ਚੱਲ ਸਕਦਾ ਇਹਨਾਂ ਨੂੰ ਆਪਣੇ ਆਂਡ ਗੁਆਂਡ ਅਤੇ ਸਮਾਜ ਨੂੰ ਦੇਖ ਕੇ ਹੀ ਕੰਮ ਜਾਂ ਆਪਣੇ ਸਹੂਲਤਾਂ ਨੂੰ ਲਿਆਉਣਾ ਪੈਂਦਾ ਹੈ ਇਹ ਆਪਣੇ ਜਿੰਮੇਵਾਰੀ ਅਤੇ ਆਪਣੇ ਜਿਹੜੇ ਸਹੂਲਤਾਂ ਨਾਲ ਜਿਹੜੇ ਸਮਾਜ ਦੇ ਕਈ ਮੁਸ਼ਕਿਲ ਹਨ ਉਹਨਾਂ ਨੂੰ ਦੂਰ ਕਰਨ ਦੇ ਵਿੱਚ ਮਦਦ ਕਰਦੇ ਹਨ ਜਿਵੇਂ ਕਿ ਬੈਂਕ ਹੋ ਗਿਆ ਬੈਂਕ ਲੋਕਾਂ ਦੀਆਂ ਲੋਨ ਅਤੇ ਉਧਾਰ ਜਾਂ ਵਿਆਜ ਲੈ ਵਿਆਜ ਦੇ ਕੰਮ ਨੂੰ ਕਰਨ ਵਿੱਚ ਮਦਦ ਕਰ ਕਰਾਉਂਦਾ ਹੈ ਇਸੇ ਤਰ੍ਹਾਂ ਇੰਸ਼ੋਰੈਂਸ ਉਹਨਾਂ ਦੇ ਜਿਹੜੇ ਕਈ ਆਉਣ ਵਾਲੇ ਖਤਰੇ ਹੁੰਦੇ ਹਨ ਜਾਂ ਉਹਨਾਂ ਦੇ ਕੋਈ ਨੁਕਸਾਨ ਹੁੰਦਾ ਹੈ ਜੇ ਜਿਹੜਾ ਪੈਸੇ ਦਾ ਨੁਕਸਾਨ ਕਰ ਸਕਦਾ ਹੈ ਜਾਂ ਕੱਲ੍ਹ ਨੂੰ ਉਹਨਾਂ ਨੂੰ ਕੋਈ ਹੋਰ ਦਿੱਕਤ ਆ ਸਕਦੀ ਹੈ ਉਹਨੂੰ ਵੀ ਕਵਰ ਕਰਦਾ ਹੈ ਇਸ ਤਰ੍ਹਾਂ ਇਹ ਦੋਨੋਂ ਹੀ ਆਪਣੇ ਪੰਜਾਬ ਦੇ ਸਮਾਜਿਕ ਜੀਵਨ ਵਿੱਚ ਬਹੁਤ ਬੜਾ ਮਹੱਤਵ ਸੰਬੰਧ ਰੱਖਦੇ ਹਨ